ਹਾਂਜੀ ਮਿਸਿਜ਼ ਜਤਿੰਦਰ ਤੁਸੀਂ ਕਾਰ ਬਹੁਤ ਵਧੀਆ ਚਲਾ ਰਹੇ ਹੋ ਮੈਂ ਹੁਣੇ ਫੋਨ ਕਰਕੇ ਪੁੱਛਿਆ ਸੀ ਆਪਾਂ ਚੰਡੀਗੜ੍ਹ ਜਾ ਰਹੇ ਹਾਂ ਅਤੇ ਚੰਡੀਗੜ੍ਹ ਰਸਤੇ 'ਚ ਟਰੈਫਿਕ ਬਹੁਤ ਹੈ ਅਤੇ ਆਪਾਂ ਨੂੰ ਹੁਣ ਹਜੇ ਆਪਾਂ ਇੱਥੇ ਪ ਬਹਾਦਰਗੜ੍ਹ ਟੋਲ ਪਲਾਜੇ 'ਤੇ ਹੀ ਪੁਹੰਚੇ ਹਾਂ ਤਾਂ ਆਪਾਂ ਨੂੰ ਕਾਫੀ ਸਮਾਂ ਲੱਗ ਜਾਣਾ ਤਾਂ ਕੀ ਕੋਈ ਹੋਰ ਰਸਤਾ ਵੀ ਹੈਗਾ ਜਿਹੜਾ ਆਪਾਂ ਨੂੰ ਚੰਡੀਗੜ੍ਹ ਬਿਨਾਂ ਟਰੈਫਿਕ ਤੋਂ ਛੇਤੀ ਪਹੁੰਚਾ ਦੇਵੇ ਅਗਰ ਹੈ ਤਾਂ ਉੱਧਰ ਨੂੰ ਆਪਾਂ ਚੱਲਦੇ ਹਾਂ ਅਤੇ ਇੱਕ ਗੱਲ ਹੋਰ ਹੈ ਜਿਹੜੇ ਤੁਸੀਂ ਗਾਣੇ ਚਲਾ ਰਹੇ ਹੋ ਅਤੇ ਇਹਨੂੰ ਬੰਦ ਕਰ ਦਿਉ ਕਿਉਂਕਿ ਮੇਰਾ ਥੋੜ੍ਹਾ ਜਿਹਾ ਸਿਰ ਦਰਦ ਹੋ ਰਿਹਾ ਅਤੇ ਜੇ ਤੁਸੀਂ ਕਰ ਦਿਉ ਤਾਂ ਬਹੁਤ ਬਹੁਤ ਧੰਨਵਾਦ ਅਤੇ ਕੋਸ਼ਿਸ਼ ਕਰੋ ਕਿ ਆਪਾਂ ਘੱਟ ਟਰੈਫਿਕ ਵਾਲੇ ਰਸਤੇ ਰਾਹੀਂ ਹੀ ਚੰਡੀਗੜ੍ਹ ਛੇਤੀ ਤੋਂ ਛੇਤੀ ਪੁਹੰਚ ਜਾਈਏ ਕਿਉਂਕਿ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਅਤੇ ਮੇਰਾ ਪਹੁੰਚਣਾ ਉੱਥੇ ਟਾਈਮ ਸਿਰ ਬਹੁਤ ਜ਼ਰੂਰੀ ਹੈ ਬਾਕੀ ਤੁਸੀਂ ਕਾਰ ਬਹੁਤ ਵਧੀਆ ਚਲਾ ਰਹੇ ਹੋ ਅਤੇ ਆਰਾਮ ਨਾਲ ਮੈਨੂੰ ਪਹੁੰਚਾਓ ਉੱਥੇ